ਹੈਲੋ ਮੇਰਾ ਨਾਮ ਸੰਜਨਾ ਹੈ ਮੈਂ ਤੁਹਾਨੂੰ ਆਪਣੀ ਜ਼ਿੰਦਗੀ ਬਾਰੇ ਦੱਸਣ ਜਾ ਰਹੀ ਹਾਂ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਇਹ ਦੱਸ ਰਹੀ ਹਾਂ ਕਿ ਸਾਨੂੰ ਕਦੇ ਵੀ ਕਿਸੇ 'ਤੇ ਟਰੱਸਟ ਨਹੀਂ ਕਰਨਾ ਚਾਹੀਦਾ ਹੈ ਮੇਰੇ ਨਾਲ ਇੱਕ ਵਾਰੀ ਇੱਦਾਂ ਹੋਇਆ ਤਾ ਕਿ ਮੈਂ ਮੈਂ ਮਤਲਬ ਕਿ ਸਾਰਿਆਂ 'ਤੇ ਟਰੱਸਟ ਕਰ ਲੈਂਦੀ ਏ ਕੋਈ ਵੀ ਮੇਰੇ ਨਾਲ ਪਿਆਰ ਨਾਲ ਗੱਲ ਕਰ ਦਿੰਦਾ ਮੈਂ ਟਰੱਸਟ ਕਰ ਲੈਂਦੀ ਅੱਗੇ ਜਾ ਕੇ ਉਹੀ ਬੰਦਾ ਜਿਸ 'ਤੇ ਮੈਂ ਟਰੱਸਟ ਕਰਦੀ ਆ ਉਹੀ ਮੈਨੂੰ ਬਾਅਦ 'ਚ ਧੋਖਾ ਦੇ ਜਾਂਦਾ ਹੈਗਾ ਮਤਲਬ ਕਿ ਹਮੇਸ਼ਾ ਗਲਤ ਏ ਹੁੰਦਾ ਮਤਲਬ ਕਿ ਮੈਂ ਜੇ ਕਿਸੇ ਨੂੰ ਕੋਈ ਚੰਗੀ ਸਲਾਹ ਦੇਵਾਂ ਉਹ ਵੀ ਉਹਨਾਂ ਨੂੰ ਬੁਰਾ ਹੀ ਲੱਗ ਜਾਂਦਾ ਇੱਕ ਵਾਰੀ ਮੈਂ ਮਤਲਬ ਕਿ ਚੰਡੀਗੜ੍ਹ ਰਹਿੰਦੀ ਸੀ ਪਹਿਲਾਂ ਤਾਂ ਉੱਥੇ ਸਾਨੂੰ ਮਤਲਬ ਕਿ ਕਿਤੇ ਔਫਿਸ ਦਾ ਐਡਰੈਸ ਚੰਗੀ ਤਰ੍ਹਾਂ ਨਹੀਂ ਪਤਾ ਸੀਗਾ ਉਹ ਕਾਫੀ ਮਤਲਬ ਕਿ ਉੱਥੇ ਦੇ ਜਿਹੜੇ ਸੜਕ ਵਗੈਰਾ ਹੈਗੇ ਆ ਉਹ ਕਾਫੀ ਜਗ੍ਹਾ 'ਤੇ ਕਰੋਸ ਹੋ ਕੇ ਜਾਂਦੇ ਰਹਿੰਦੇ ਤਾਂ ਇਹਦੇ ਨਾਲ ਨਾ ਅਸੀਂ ਭਟਕ ਜਾਂਦੇ ਸੀਗੇ ਤਾਂ ਅਸੀਂ ਸਾਡੇ ਨਾਲ ਇੱਦਾਂ ਹੋਇਆ ਸੀ ਨਾ ਅਸੀਂ ਨਾ ਇੱਕ ਮਤਲਬ ਬੰਦੇ ਨਾਲ ਪੁੱਛਿਆ ਕਿ ਤੁਸੀਂ ਸਾਨੂੰ ਇੱਥੇ ਦਾ ਆਫਿਸ ਦਾ ਐਡਰੈਸ ਦੱਸ ਦੋ ਉਹਨਾਂ ਨੇ ਸਾਨੂੰ ਗਲਤ ਐਡਰੈਸ ਦੱਸਤਾ ਅਸੀਂ ਹੁਣ ਘੁੰਮ ਫਿਰ ਕੇ ਅਸੀਂ ਉੱਥੇ ਜਗ੍ਹਾ 'ਤੇ ਵਾਪਿਸ ਆ ਜਾਂਦੇ ਸੀਗੇ ਕੀ ਸਾਡਾ ਔਫਿਸ ਜਾਣ ਦਾ ਟਾਈਮ ਇੰਨਾ ਸਾਡਾ ਵੇਸਟ ਹੋਇਆ ਅਸੀਂ ਟਾਈਮ ਨਾਲ ਔਫਿਸ ਨਹੀਂ ਪੁੱਜੇ ਅਤੇ ਸਾਨੂੰ ਉੱਥੇ ਸਾਡੇ ਔਫਿਸ ਦੇ ਹੈੱਡ ਨਾਲ ਵੀ ਸਾਡੀ ਮਤਲਬ ਕਿ ਗੱਲ ਖਰਾਬ ਹੋ ਗਈ ਔਫਿਸ ਦੇ ਹੈੱਡ ਵੀ ਸਾਡੇ ਨਾਲ ਗੁੱਸਾ ਹੋ ਗਿਆ ਸੀ ਤਾਂ ਸਾਨੂੰ ਇਹ ਸੀਗਾ ਕਿ ਅਸੀਂ ਅਗਲੇ 'ਤੇ ਟਰੱਸਟ ਕਰਕੇ ਪੁੱਛਿਆ ਉਹਨੇ ਸਾਡਾ ਟਰੱਸਟ ਤੋੜ ਦਿਤਾ ਠੀਕ ਹੈ ਅੱਗੇ ਸਾਡੇ ਨਾਲ ਇੱਦਾਂ ਵੀ ਹੋਇਆ ਸੀ ਕਿ ਇੱਕ ਕੁੜੀ ਨੇ ਮਤਲਬ ਕਿ ਕੁੜੀ ਨਾਲ ਵੀ ਐਦੀ ਹੋਇਆ ਸੀਗਾ ਉਹਨੇ ਮਤਲਬ ਅਸੀਂ ਉਸ ਤੋਂ ਵੀ ਮਤਲਬ ਕਿ ਹੈਲਪ ਮੰਗੀ ਸੀਗੀ ਅਸੀਂ ਟਰੱਸਟ ਕਰਕੇ ਹੈਲਪ ਮੰਗਿਆ ਸੀ ਉਸ ਤੋਂ ਅਗਲੀ ਸਾਨੂੰ ਕਹਿੰਦੀ ਠੀਕ ਆ ਹਾਂ ਅਸੀਂ ਕਰਦੂਂਗੇ ਬਾਅਦ 'ਚ ਉਹ ਉਹ ਵੀ ਮੁੱਕਰਗੀ ਕਿ ਹਾਂ ਮੇਰੇ ਤੋਂ ਨਹੀਂ ਹੋਣਾ ਇੱਦਾਂ ਕੁਝ ਕੁਝ ਵੀ ਫਿਰ ਮੈਂ ਮਤਲਬ ਕਿ ਕਾਫੀ ਇੱਦਾਂ ਦਾ ਨੇਚਰ ਹੈ ਕਿ ਮੈਂ ਕਿਸੀ 'ਤੇ ਵੀ ਬਹੁਤ ਛੇਤੀ ਟਰੱਸਟ ਕਰ ਲੈਂਦੀ ਆ ਬਾਅਦ 'ਚ ਉਹ ਟਰੱਸਟ ਨਾ ਮਤਲਬ ਟੁੱਟ ਜਾਂਦਾ ਅਤੇ ਇਸ ਲਈ ਨਾ ਕਿ ਨਾ ਹੁਣ ਤਾਂ ਮੈਨੂੰ ਇਹੀ ਸਬਕ ਮਿਲ ਗਿਆ ਏ ਕਿ ਜੋ ਮਰਜ਼ੀ ਕੁਝ ਕਰੋ ਕਿਸੀ ਦਾ ਨਾ ਸੁਣੋ ਆਪਣੇ ਮਨ ਦੀ ਸੁਣੋ ਆਪਣੇ 'ਤੇ ਟਰੱਸਟ ਕਰੋ ਬਸ